ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਪਾਲ ਰੈਸਟੋਰੈਂਟ ਤੋਂ ਬੋਲ ਰਹੇ ਤੁਸੀਂ ਜੀ ਅਸੀਂ ਥੋੜ੍ਹੀ ਜਿਹੀਆਂ ਮਿਠਾਈਆਂ ਲੈਣੀਆਂ ਹੈ ਸਾਡੇ ਪ੍ਰੋਗਰਾਮ ਹੈ ਜੀ ਤੁਹਾਡੇ ਕੋਲ਼ ਬਰਫ਼ੀ ਹੈਗੀ ਹੈ ਹਲਵਾ ਗੁਲਾਬ ਜਾਮੁਣ ਹੈਗੀ ਹੈ ਜੀ ਰਸਗੁੱਲੇ ਹੈਗੇ ਹੈ ਜੀ ਠੀਕ ਹੈ ਜੀ ਮਿਠਾਈ ਵਧੀਆ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਤੁਸੀਂ ਭਾਅ ਜੀ ਇੱਦਾਂ ਕਰੋ ਪੰਜ ਕਿੱਲੋ ਗੁਲਾਬ ਜਾਮਣਾਂ ਪੰਜ ਕਿੱਲੋ ਰਸਗੁੱਲੇ ਅਤੇ ਪੰਜ ਕਿੱਲੋ ਬਰਫ਼ੀ ਦਾ ਅਸੀਂ ਔਰਡਰ ਦੇ ਰਹੇ ਤੁਹਾਨੂੰ ਅਤੇ ਭੇਜਣੇ ਦੀ ਕਿਰਪਾਲਤਾ ਕਰਨੀ ਜੀ ਹਾਂਜੀ ਧੰਨਵਾਦ ਜੀ